ਪੰਜਾਬੀ ਲੋਕ ਆਪਣੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਮਨਾਉਣ ਅਤੇ ਸਨਮਾਨ ਦੇਣ ਲਈ ਆਪਣੀ ਮਾਤਰ ਭਾਸ਼ਾ ਪੰਜਾਬੀ ਦੀ ਵਰਤੋਂ ਕਰਦੇ ਹਨ ਉਹ ਇਸ ਭਾਸ਼ਾ ਦੀ ਵਰਤੋਂ ਜਿਵੇਂ ਕਿ ਪੰਜਾਬੀ ਸੰਗੀਤ ਅਤੇ ਡਾਂਸ ਵਿੱਚ ਵੀ ਕਰਦੇ ਹਨ ਜਿਵੇਂ ਸੰਗੀਤ ਵਿੱਚ ਬੋਲੀਆਂ ਪਾਉਣੀਆਂ ਆਪਣੇ ਟਿੱਪਣੀਆਂ ਪਾਉਣੀਆਂ ਉਸ ਤੋਂ ਬਾਅਦ ਗੱਲਾਂ ਬਾਤਾਂ ਕਰਨ ਵਿੱਚ ਇੱਕ ਦੂਜੇ ਨਾਲ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਉਦੋਂ ਪੰਜਾਬੀ ਭਾਸ਼ਾ ਦੀ ਯੂਸ ਕਰਨਾ ਵਰਤੋਂ ਕਰਨਾ ਮੁਹਾਵਰੇ ਵਗੈਰਾ ਦਾ ਯੂਸ ਕਰਨਾ ਜਾਂ ਆਪਾਂ ਮੁਹਾਵਰੇ ਦਾ ਪ੍ਰਯੋਗ ਕਰਦੇ ਹਾਂ ਪੰਜਾਬੀ ਵਿੱਚ ਇੱਕ ਦੂਜੇ ਨੂੰ ਤਾਨਾ ਮਾਰਦੇ ਹਾਂ ਉਦੋਂ ਵੀ ਆਪਾਂ ਪੰਜਾਬੀ ਦਾ ਯੂਸ ਕਰ ਲੈਦੇ ਹਾਂ ਅਤੇ ਪੰਜਾਬੀ ਭਾਸ਼ਾ ਇੱਕ ਬਹੁਤ ਹੀ ਵਧੀਆ ਭਾਸ਼ਾ ਹੈ ਇਹਨੂੰ ਆਪਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਯੂਸ ਕਰ ਸਕਦੇ ਹੈ ਆਪਸ 'ਚ ਆਪਾਂ ਕਿਸੇ ਨਾਲ ਗੱਲ ਕਰ ਰਹੇ ਹਾਂ ਫਿਰ ਵੀ ਆਪਾਂ ਯੂਸ ਕਰ ਸਕਦੇ ਹਾਂ ਅਤੇ ਇਹ ਇਹ ਬਸ ਇਹੀ ਹੈ ਕਿ ਆਪਾਂ ਇਹ ਸਿਰਫ ਪੰਜਾਬ ਵਿੱਚ ਯੂਜ ਕਰ ਸਕਦੇ ਹਾਂ ਬਾਹਰ ਆਪਾਂ ਤੱਦ ਹੀ ਇਹਨੂੰ ਯੂਸ ਕਰ ਸਕਦੇ ਹਾਂ ਜੇਕਰ ਬਾਹਰ ਕਿਸੇ ਨੂੰ ਪੰਜਾਬੀ ਆਉਂਦੀ ਹੋਵੇ ਲੇਕਿਨ ਆਪਾਂ ਪੰਜਾਬ ਵਿੱਚ ਰਹਿ ਕੇ ਪੰਜਾਬੀ ਦੇ ਵਰਤੋਂ ਤਾਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਇੱਕ ਦੂਜੇ ਨਾਲ ਗੱਲ ਕਰਨ ਦੇ ਲਈ